ਗੁਡ ਈਵਨਿੰਗ ਸਰ ਮੈਂ ਆਪਸੇ ਪੰਜਾਬ ਕੀ ਹਿਸਟਰੀ ਬਾਰੇ ਮੇਂ ਜਾਣਨਾ ਚਾਹਤਾ ਹੂੰ ਹੈਲੋ ਗੁਡ ਈਵਨਿੰਗ ਸਰ ਮੈਂ ਆਪਸੇ ਪੰਜਾਬ ਕੀ ਹਿਸਟਰੀ ਕੇ ਬਾਰੇ ਮੇਂ ਜਾਣਨਾ ਚਾਹਤਾ ਹੂੰ ਹਾਂਜੀ ਹਾਂਜੀ ਓਕੇ ਓਕੇ ਜੀ ਅਤੇ ਆਪਣੇ ਸੱਭਿਆਚਾਰਕ ਆਪਣੇ ਹਿਸਟਰੀ ਦੇ ਵਿੱਚ ਜਿਹੜੇ ਪੰਜਾਬ ਦੇ ਸੱਭਿਆਚਾਰਕ ਉਹ ਨੇ ਉਹਦੇ ਬਾਰੇ ਦੱਸੋ ਥੋੜ੍ਹਾ ਜਿਹਾ ਅਤੇ ਆਪਣੇ ਪੰਜਾਬ ਦੇ ਪ੍ਰਸਿੱਧ ਤਿਉਹਾਰ ਕਿਹੜੇ ਨੇ ਜਿਹੜੇ ਕਿ ਪੰਜਾਬੀ ਆਪਣੇ ਬਹੁਤ ਚਾਵਾਂ ਨਾਲ ਮਨਾਉਂਦੇ ਨੇ

ਇੱਕ ਆਪਣੇ ਇੱਕ ਆਪਣੇ ਪੰਜਾਬ ਦਾ ਸਭ ਤੋਂ ਵਧੀਆ ਵੀ ਲੋਕ ਪ੍ਰਿਯਾ ਖਾਣਾ ਕਿਹੜਾ ਗਾ ਆਪਣੇ ਆਪਣਾ ਸਭ ਤੋਂ ਆਮ ਤੌਰ 'ਤੇ ਚੱਲਣ ਵਾਲੀ ਸੋਫਟ ਡਰਿੰਕ ਪੰਜਾਬ ਦੇ ਵਿੱਚ ਨਿੰਬੂ ਥੈਂਕ ਯੂ ਸਰ